ਉਂਝ ਤਾਂ ਬਿਜਲੀ ਸਾਡੇ ਘਰ ਜਾਂਦੀ ਨਹੀਂ ਹੈ ਕਿਉਂਕਿ ਬਿਜਲੀ ਦੇ ਕੱਟ ਬਹੁਤ ਹੀ ਘੱਟ ਲੱਗਦੇ ਹਨ ਪਰ ਜਦੋਂ ਬੇਮੌਸਮੀ ਬਰਸਾਤ ਜਾਂ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਹੋਵੇ ਫਿਰ ਬਿਜਲੀ ਦੇ ਕੱਟ ਲੱਗ ਜਾਂਦੇ ਹਨ ਜਿਸ ਨਾਲ ਕੀ ਹੈ ਕਿ ਸਾਡੀ ਲਾਇਫ਼ ਪ੍ਰਭਾਵਿਤ ਹੋ ਜਾਂਦੀ ਹੈ ਕਿਉਂਕਿ ਸ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਮਸ਼ੀਨਾਂ ਇਲੈਕਟ੍ਰਾਨਿਕ ਹਨ ਜਦੋਂ ਵੀ ਕੋਈ ਵੀ ਬਿਜਲੀ ਜਾਂਦੀ ਹੈ ਤਾਂ ਸਾਰੇ ਸਾਡੇ ਕੰਮ ਨੇ ਠੱਪ ਹੋ ਜਾਂਦੇ ਹਨ ਅਤੇ ਜਿਸ ਨਾਲ ਸਾਡਾ ਜੀਵਨ ਪ੍ਰਭਾਵਿਤ ਹੋ ਜਾਂਦਾ ਹੈ ਜ਼ਿਲ੍ਹਾ ਪ੍ਰਬੰਧਕ ਨੂੰ ਚਾਹੀਦਾ ਹੈ ਕਿ ਜਿਹੜੀ ਬਿਜਲੀ ਦੀਆਂ ਸਮੱਸਿਆਵਾਂ ਹਨ ਉਹ ਜਲਦੀ ਤੋਂ ਜਲਦੀ ਦੂਰ ਕਰਨ ਤਾਂਕਿ ਲੋਕ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ